ਮੈਂ ਜੱਚਦੇ ਰੰਗ ਦੇਖ ਕੇ ਫਿਰ ਰੰਗ ਦਾ ਚੁਣਾਓ ਕਰਦੀ ਹਾਂ ਔਰ ਜਿਹੜੇ ਰੰਗ ਆਪਸ ਵਿੱਚ ਮਿਲਣ ਇੱਕ ਦੂਸਰੇ 'ਤੇ ਫੱਬਣ ਉਹੀ ਉਨ੍ਹਾਂ ਦਾ ਚੁਣਾਓ ਕਰਦੀ ਹਾਂ ਮੇਰਾ ਮਨਪਸੰਦ ਰੰਗ ਕਾਲਾ ਹੈ